ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਸਾਧਨ ਜਿਵੇਂ ਸਭ ਤੋਂ ਪਹਿਲਾਂ ਤਾਂ ਮੇਨ ਹੈ ਟਰੈਕਟਰ ਟਰੈਕਟਰ ਅੱਜ ਕੱਲ੍ਹ ਲਗਭਗ ਜਿਹੜੇ ਜਿਹੜੇ ਵੀ ਲੋਕ ਖੇਤੀਬਾੜੀ ਕਰਦੇ ਆ ਹਰੇਕ ਘਰ ਦੇ ਵਿੱਚ ਟਰੈਕਟਰ ਤਾਂ ਜ਼ਰੂਰੀ ਆ ਹਰੇਕ ਘਰ ਦੇ ਵਿੱਚ ਟਰੈਕਟਰ ਦੇ ਨਾਲ ਖੇਤੀਬਾੜੀ ਕੀਤੀ ਜਾਂਦੀ ਆ ਅਤੇ ਟਰੈਕਟਰ ਦੀ ਅੱਜ ਕੱਲ੍ਹ ਜਿਵੇਂ ਖੇਤੀਬਾੜੀ ਦੇ ਬਹੁਤ ਹੀ ਜ਼ਰੂਰਤ ਜਿਵੇਂ ਮਸ਼ੀਨੀ ਯੁੱਗ ਆ ਗਿਆ ਅੱਜ ਕੱਲ੍ਹ ਮਸ਼ੀਨੀ ਯੁੱਗ ਦੇ ਵਿੱਚ ਟਰੈਕਟਰ ਦੀ ਬਹੁਤ ਜ਼ਿਆਦਾ ਮੰਗ ਵੱਧ ਗਈ ਆ ਅਤੇ ਟਰੈਕਟਰ ਦੇ ਨਾਲ ਨਾਲ ਹੋਰ ਜਿਵੇਂ ਹਲ ਹੋ ਗਏ ਜਿਵੇਂ ਜ਼ਮੀਨ ਨੂੰ ਵਾਹੁਣ ਦੇ ਲਈ ਹਲਾਂ ਹਲਾਂ ਦੀ ਬਹੁਤ ਜ਼ਿਆਦਾ ਹਲਾਂ ਨਾਲ ਹੀ ਜ਼ਮੀਨ ਨੂੰ ਵਾਹਿਆ ਜਾਂਦਾ ਫੇਰ ਹੀ ਅੱਜ ਕੱਲ੍ਹ ਜਿਵੇਂ ਫਸਲਾਂ ਫਸਲਾਂ ਦੀ ਉਤਪਤੀ ਵੱਧ ਹੋ ਰਹੀ ਆ ਅਤੇ ਤਵੀਆਂ ਲਾ ਲਓ ਤਵੀਆਂ ਵੀ ਤਵੀਆਂ ਵੀ ਜ਼ਮੀਨ ਨੂੰ ਵਾਹੁਣ ਦੇ ਲਈ ਉਪਯੋਗ ਕੀਤਾ ਜਾਂਦਾ ਅਤੇ ਜਿਵੇਂ ਕੰਬਾਈਨ ਲਾ ਲਓ ਕੰਬਾਈਨ ਨੂੰ ਕੰਬਾਈਨ ਨੂੰ ਫਸਲ ਨੂੰ ਵੱਢਣ ਲਈ ਵਰਤਿਆ ਜਾਂਦਾ ਹੈ ਕੰਬਾਈਨਾਂ ਦਾ ਵੀ ਅੱਜ ਕੱਲ੍ਹ ਦੇ ਯੁੱਗ ਵਿੱਚ ਬਹੁਤ ਜ਼ਰੂਰੀ ਹੋ ਗਈਆਂ ਕੰਬਾਈਨਾਂ ਵੀ ਅਤੇ ਕੰਬਾਈਨਾਂ ਦੇ ਨਾਲ ਕਿ ਅੱਜ ਕੱਲ੍ਹ ਫਸਲਾਂ ਦੀ ਜਿਹੜੀ ਵਾਢੀ ਆ ਉਹ ਬਹੁਤ ਜਲਦੀ ਹੋ ਜਾਂਦੀ ਆ ਅਤੇ ਇਹਨੇ ਆਪਣੇ ਕੰਬਾਈਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਖੇਤੀਬਾੜੀ ਨੂੰ ਅੱਗੇ ਲਿਜਾਣ ਲਈ ਅਤੇ ਜਿਵੇਂ ਟਰਾਲੀਆਂ ਹੋ ਗਈਆਂ ਟਰਾਲੀਆਂ ਦੇ ਨਾਲ ਵੀ ਫਸਲਾਂ ਨੂੰ ਢੋਣ ਦੇ ਲਈ ਫਸਲਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਣ ਲਈ ਟਰਾਲੀਆਂ ਦਾ ਵੀ ਅੱਜ ਦੇ ਟਾਈਮ ਵਿੱਚ ਬਹੁਤ ਜ਼ਰੂਰੀ ਹੋ ਗਿਆ ਕੰਮ ਅਤੇ ਖੇਤੀਬਾੜੀ ਦੇ ਵਿੱਚ ਹੋਰ ਬਹੁਤ ਸਾਰੇ ਸਾਧਨ ਆ ਜਿਵੇਂ ਤੂੜੀ ਬਣਾਉਣ ਵਾਲੀ ਮਸ਼ੀਨ ਹੋ ਗਈ ਅਤੇ ਜਿਵੇਂ ਅੱਜ ਕੱਲ੍ਹ ਪਸ਼ੂਆਂ ਨੂੰ ਚਾਰੇ ਦੇ ਲਈ ਤੂੜੀ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ ਅਤੇ ਉਸ ਦੇ ਲਈ ਕੀ ਆ ਤੂੜੀ ਬਣਾਉਣ ਵਾਲੀ ਮਸ਼ੀਨ ਬਹੁਤ ਲਾਭਦਾਇਕ ਸਿੱਧ ਹੋਈ ਆ ਅਤੇ ਖੇਤੀਬਾੜੀ ਦੇ ਵਿੱਚ ਤਾਂ ਬਹੁਤ ਸਾਰੇ ਸੰਦ ਆ ਜਾਂਦੇ ਆ ਜਿਵੇਂ ਅੱਜ ਕੱਲ੍ਹ ਰੂਟਾਵੀਟਰ ਆਇਆ ਅੱਜ ਕੱਲ੍ਹ ਜੋ ਜ਼ਮੀਨ ਨੂੰ ਬਹੁਤ ਵਧੀਆ ਪੋਲਾ ਬਣਾ ਦਿੰਦਾ ਰੂਟਾਵੇਟਰ ਅਤੇ ਨਾਲ ਬਰਾਬਰ ਇੱਕ ਤਹਿ ਕਰ ਦਿੰਦਾ ਜਿਵੇਂ ਇੱਕ ਅੱਜ ਕੱਲ੍ਹ ਹੋਰ ਆਇਆ ਕੰਪ ਕੰਪਿਊਟਰ ਕਰਾਹਾ ਪਹਿਲਾਂ ਕੀ ਸੀ ਵੀ ਜ਼ਮੀਨ ਦਾ ਜਿਹੜਾ ਲੇਵਲ ਆ ਉਹ ਪੱਧਰਾ ਨਹੀਂ ਸੀ ਹੁੰਦਾ ਹੁਣ ਕੀ ਆ ਕੰਪਿਊਟਰ ਕਰੇ ਨਾਲ ਬਿਲਕੁਲ ਜ਼ੀਰੋ ਲੈਵਲ ਹੋ ਜਾਂਦਾ ਜ਼ਮੀਨ ਦਾ ਜਿਸ ਨਾਲ ਕੀ ਆ ਪਾਣੀ ਦੀ ਬੱਚਤ ਹੋ ਰਹੀ ਆ ਅਤੇ ਬਹੁਤ ਹੀ ਲਾਭ ਹੋ ਰਿਹਾ ਜਿਸ ਨਾਲ ਇਸ ਲਈ ਲਗਭਗ ਹਰ ਇੱਕ ਸਾਧਨ ਸੇਵਾ ਸੇਵਾ ਕਰ ਰਿਹਾ ਲਗਭਗ